ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਤੁਹਾਡੇ ਕੋਲੋਂ ਪੁੱਛਣਾ ਸੀਗਾ ਕਿ ਮੈਨੂੰ ਤੁਸੀਂ ਹਿਸਟੋਰੀਕਲ ਗੁਰਦੁਆਰਿਆਂ ਬਾਰੇ ਥੋੜ੍ਹੀ ਜਿਹਾ ਦੱਸ ਸਕਦੇ ਹੋ ਮੇਰਾ ਕੱਲ੍ਹ ਇੱਕ ਟੋਪਿਕ ਹੈ ਜਿਸਦੇ ਉੱਪਰ ਮੇਰਾ ਸੈਮੀਨਾਰ ਹੈ ਨਹੀਂ ਨਹੀਂ ਮੈਮ ਅੰਮ੍ਰਿਤਸਰ ਦੇ ਹੀ ਦੱਸ ਦਿਓ ਸਾਨੂੰ ਹਾਂ ਥੋੜਾ ਜਿਹਾ ਮਤਲਬ ਮੇਨ ਮੇਨ ਓਵਰਵਿਊ ਹਾਂਜੀ ਹਾਂਜੀ ਹਾਂਜੀ ਓਕੇ ਅੱਛਾ ਉਹ ਅੰਮ੍ਰਿਤਸਰ ਦੇ ਵਿੱਚ ਹੀ ਕੰਸੀਡਰ ਹੋਊਗਾ ਉਹ ਤਾਂ ਤਰਨਤਾਰਨ ਵਿੱਚ ਨਹੀਂ ਜਾਏਗਾ

ਫਿਰ ਤਾਂ ਇਹ ਵਾਲੇ ਵੀ ਗੁਰਦੁਆਰਾ ਆ ਜਾਣਗੇ ਜਿਹੜੇ ਇੱਕ ਸੀਗਾ ਨਾ ਜਿਹੜੇ ਛੇਹਰਟਾ ਸਾਹਿਬ ਹਾਂ ਗੁਰੂ ਕੀ ਬਡਾਲੀ ਫਿਰ ਤਾਂ ਕਾਫ਼ੀ ਸਾਰੇ ਦਸ ਹਾਂ ਦਸ ਕੁ ਹੋ ਜਾਣਗੇ ਸਾਹਿਬ ਵੀ ਹੈਗਾ ਹੂੰ ਨਹੀਂ ਨਹੀਂ ਬਸ ਕਾਫ਼ੀ ਆ ਮੈਮ ਫਿਰ ਥੈਂਕ ਯੂ ਇੰਨਾ ਕੁ ਹੋ ਗਿਆ ਬਾਕੀ ਮੈਂ ਦੇਖਲਵਾਂਗੀ ਥੈਂਕ ਯੂ ਮੈਮ ਥੈਂਕ ਯੂ ਸੋ ਮਚ